ਤਿੰਨ ਫਰਵਰੀ ਉੱਨੀ ਤਰਿਆਸੀ ਅੱਠ ਮਾਰਚ ਉੱਨੀ ਨੜ੍ਹਿਨਵੇਂ ਤੇਰਾਂ ਅਪ੍ਰੈਲ ਵੀਹ ਬਾਰਾਂ ਤੇਈ ਸਤੰਬਰ ਵੀਹ ਅਠਾਰਾਂ ਤੀਹ ਮਈ ਵੀਹ ਬਾਈ